ਮੈਂ ਸਾਹਿਤਕ ਜਗਤ ਵਿੱਚ ਖੋਜਾਰਥੀ ਦੇ ਵਜੋਂ ਕੰਮ ਕਰ ਰਿਹਾ ਹਾਂ ਮੈਂ ਇਸ ਖੇਤਰ ਵਿੱਚ ਮੁੱਖ ਤੌਰ 'ਤੇ ਵਿਅੰਗ ਨਾਲ ਸੰਬੰਧਿਤ ਕਿਤਾਬਾਂ ਦੀ ਲੜੀ ਦੇ ਨਾਲ ਜੁੜਿਆ ਹੋਇਆ ਹਾਂ ਜੋ ਲਗਾਤਾਰ ਵਿਅੰਗ ਦੇ ਖੇਤਰ ਵਿੱਚ ਕਿਤਾਬਾਂ ਨਿਕਲ ਰਹੀਆਂ ਹਨ ਉਹਨਾਂ ਨੂੰ ਮੈਂ ਲਗਾਤਾਰ ਪੜ੍ਹ ਰਿਹਾ ਹਾਂ ਉਸ ਦੇ ਵਿੱਚ ਮੈਂ ਮੁੱਖ ਤੌਰ 'ਤੇ ਆਪਣੇ ਵਿਸ਼ੇ ਨਾਲ ਸੰਬੰਧਿਤ ਜੋ ਮੇਰਾ ਵਿਸ਼ਾ ਹੈ ਚੋਣਵੇਂ ਨਾਵਲਾਂ ਵਿੱਚ ਵਿਅੰਗ ਉਸਦੇ ਵਿੱਚ ਮੈਂ ਕਿਤਾਬਾਂ ਨੂੰ ਪੜ੍ਹ ਰਿਹਾ ਹਾਂ ਉਸ ਦੀ ਲੜੀ ਦੇ ਵਜੋਂ ਮੈਂ ਰਾਗ ਦਰਬਾਰੀ ਤਮਾਸ਼ਾ ਜੁਗਤੋਂ ਅਤੇ ਕਹਾਣੀ ਇੱਕ ਇੱਜੜ ਦੀ ਤੋਂ ਇਲਾਵਾ ਵੀ ਬਹੁਤ ਸਾਰੇ ਨਾਵਲ ਜਿਵੇਂ ਬੰਦੀਵਾਨ ਸੱਤ ਗਵਾਚੇ ਲੋਕ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਜਿਵੇਂ ਕਿ ਹਟਲੇ ਦੀ ਡਾਇਰੀ ਇਹਨਾਂ ਕਿਤਾਬਾਂ ਨੂੰ ਪੜ੍ਹ ਰਿਹਾ ਹਾਂ ਇਹਨਾਂ ਕਿਤਾਬਾਂ ਦੇ ਵਿੱਚੋਂ ਹੀ ਮੈਂ ਆਪਣੇ ਜਿਹੜਾ ਖੋਜ ਕਾਰਜ ਨੂੰ ਤਰਜੀਹ ਦਿੱਤੀ ਹੈ ਉਹਨਾਂ ਨੂੰ ਹੀ ਮੈਂ ਬੜਾਵਾ ਦੇ ਰਿਹਾ ਹਾਂ ਮੈਂ ਇਸ ਸਾਹਿਤਕ ਜਗਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਹੋਰ ਫੀਲਡ ਦੇ ਨਾਲ ਸੰਬੰਧਿਤ ਵੀ ਕਿਤਾਬਾਂ ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਉਸ ਫੀਲਡ ਦੇ ਵਿੱਚ ਹੋਰ ਨਿਕਲ ਰਹੀਆਂ ਕਿਤਾਬਾਂ ਤੋਂ ਵੀ ਜਾਣੂ ਹੁੰਦਾ ਹੋਣਾ ਪੈਂਦਾ ਤਾਂ ਅਸੀਂ ਇਸ ਲੜੀ ਦੇ ਵਿੱਚੋਂ ਹੀ ਮੈਂ ਸਾਹਿਤ ਨਾਲ ਅਤੇ ਸਾਹਿਤ ਅਤੇ ਇਤਿਹਾਸ ਦੇ ਸੰਬੰਧ ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਰਿਹਾ ਹਾਂ ਜਿਹਦੇ ਵਿੱਚੋਂ ਸੁਖਦਿਆਲ ਦੀ ਕਿਤਾਬਾਂ ਦੀ ਲੜੀ ਹੈ ਜੋ ਪੰਜਾਬ ਦਾ ਇਤਿਹਾਸ ਤਿੰਨ ਲਗਾਤਾਰ ਵੋਲਿਊਮ ਦੇ ਵਿੱਚ ਛਪੀ ਆ ਉਸ ਤੋਂ ਇਲਾਵਾ ਖੁਸ਼ਵੰਤ ਸਿੰਘ ਦੇ ਇਤਿਹਾਸ ਵੀ ਮੈਂ ਪੜ੍ਹ ਚੁੱਕਿਆ ਹਾਂ ਤਾਂ ਮੇਰਾ ਇਸਦੇ ਨਾਲ ਹੀ ਜਿਹੜਾ ਹੈ ਸਪਤ ਸਿੰਧੂ ਕਿਤਾਬ ਸੁਰਿੰਦਰ ਕੁਮਾਰ ਨਿਵੇਸ਼ਵਰ ਦੀ ਵੀ ਮੈਂ ਪੜ੍ਹ ਰਿਹਾ ਹਾਂ ਤਾਂ ਜੋ ਮੈਂ ਆਪਣੇ ਆਪ ਨੂੰ ਨਵਿਆਉਂਦਾ ਰਹਾਂ ਅਤੇ ਜਿਹੜੀਆਂ ਮੈਂ ਸਾਹਿਤਿਕ ਰਚਨਾਵਾਂ ਦੀ ਖੋਜ ਕਰਨੀ ਹੈ ਉਹਨਾਂ ਦੇ ਇਤਿਹਾਸਿਕ ਪਿਛੋਕੜ ਤੋਂ ਸੱਭਿਆਚਾਰਿਕ ਪਿਛੋਕੜ ਤੋਂ ਮੈਂ ਜਾਣੂ ਹੋਣ ਲਈ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ